ਮੇਰੀ ਸੱਸ ਕਾਫੀ ਦੇਰ ਤੋਂ ਬਿਮਾਰ ਹੈਗੀ ਆ ਅਤੇ ਉਹਨੂੰ ਮਤਲਬ ਬੈਡ ਰੈਸਟ ਹੀ ਹੈਗੀ ਬੈਡ 'ਤੇ ਹੀ ਹੈਗੀ ਆ ਉਹ ਉਹਨਾਂ ਨੂੰ ਸਾਨੂੰ ਨਰਸਿੰਗ ਦੀ ਜ਼ਰੂਰਤ ਹੈਗੀ ਅਤੇ ਸਾਨੂੰ ਵੀ ਪਤਾ ਹੈਗਾ ਆ ਵੀ ਬੀਮਾ ਵਾਲੇ ਏ ਇਹਦੀ ਕਵਰਿੰਗ ਕਰ ਰਹੇ ਆ ਕੇ ਨਹੀਂ ਸਾਡੇ ਹੋਰ ਰਿਸ਼ਤੇਦਾਰਾਂ ਦੇ ਵਿੱਚ ਤਾਂ ਬੀਮੇ ਵਾਲੇ ਕਰਦੇ ਆ ਸਾਡੀ ਕੋਈ ਵੀ ਕਿਸ਼ਤ ਨਹੀਂ ਇੱਦਾਂ ਰੁਕੀ ਤੁਹਾਡੇ ਤੋਂ ਅਤੇ ਸਾਨੂੰ ਇਹਦੀ ਇਹਦੇ ਬਾਰੇ ਪੂਰੀ ਸਾਨੂੰ ਜਾਣਕਾਰੀ ਦੇ ਬਾਰੇ ਦੱਸੋ ਅਤੇ ਸਾਨੂੰ ਦੱਸੋ ਕਿ ਇਹਦੇ ਲਈ ਨਰਸਿੰਗ ਦੀ ਤੁਹਾਡੇ ਕੋਲ ਹੈਗੀ ਆ ਕੋਈ ਐਪੇਚੁਲਟੀ ਅਤੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ ਸਰ ਸਾਨੂੰ ਜ਼ਰੂਰ ਦੱਸੋ